ਇੱਕ ਵਾਰ ਸਾਡੇ ਸ਼ਹਿਰ ਵਿੱਚ ਇਨਟੀਕ ਚੀਜ਼ਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ ਜਿੱਥੇ ਕਿ ਪੁਰਾਣੇ ਸਮੇਂ ਸਮਿਆਂ ਦੀਆਂ ਚੀਜ਼ਾਂ ਜਿਵੇਂ ਕਿ ਸਿੱਕੇ ਸਟੈਂਪਾਂ ਅਤੇ ਹੋਰ ਐਂਟੀਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲੱਗੀ ਹੋਈ ਸੀ ਜਿੱਥੇ ਮੈਂ ਵੀ ਪ੍ਰਦਰਸ਼ਨੀ ਸਟਾਲ ਵਾਲਿਆਂ ਨਾਲ ਗੱਲ ਕੀਤੀ ਕਿ ਮੇਰੇ ਕੋਲ ਵੀ ਪੁਰਾਣੇ ਸਮਿਆਂ ਦੇ ਸਿੱਕੇ ਅਤੇ ਹੋਰ ਕਾਫੀ ਜ਼ਿਆਦਾ ਕਲੈਕਸ਼ਨ ਹੈ ਤਾਂ ਉਹਨਾਂ ਨੇ ਮੈਨੂੰ ਆਪਣੀ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਮੈਂ ਉਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਮੇਰੇ ਕੋਲ ਜੋ ਵੀ ਐਂਟੀਕ ਚੀਜ਼ਾਂ ਦੀ ਕਲੈਕਸ਼ਨ ਸੀ ਮੈਂ ਘਰੋਂ ਲੈ ਗਿਆ ਅਤੇ ਪ੍ਰਦਰਸ਼ਨੀ ਵਾਲੀ ਸਟਾਲ 'ਤੇ ਜਾ ਕੇ ਆਪਣੀਆਂ ਇਹ ਸਾਰੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾ ਦਿੱਤੀ ਜਿਹਨਾਂ ਨੂੰ ਦੇਖ ਕੇ ਕਾਫੀ ਲੋਕ ਪ੍ਰਭਾਵਿਤ ਵੀ ਹੋਏ ਕਿ ਤੁਸੀਂ ਇਹ ਕਾਫੀ ਪੁਰਾਣੇ ਸਮੇਂ ਦੇ ਸਿੱਕੇ ਜੋ ਸ਼ਾਇਦ ਹੀ ਉਹਨਾਂ ਨੇ ਦੇਖੇ ਸੀ ਉਹਨੂੰ ਵੇਖ ਕੇ ਉਹ ਬਹੁਤ ਹੀ ਹੈਰਾਨ ਹੋਏ ਅਤੇ ਇਹ ਸਾਰੀ ਕਲੈਕਸ਼ਨ ਦੇਖ ਕੇ ਲੋਕਾਂ ਨੇ ਮੇਰੀ ਕਾਫੀ ਵ ਜ਼ਿਆਦਾ ਤਾਰੀਫ ਵੀ ਕੀਤੀ ਅਤੇ ਪ੍ਰਦਰਸ਼ਨੀ ਸਟਾਲ ਵਾਲਿਆਂ ਨੇ ਮੇਰੀ ਇਹ ਕਲੈਕਸ਼ਨ ਦੇਖ ਕੇ ਕਾਫੀ ਖੁਸ਼ੀ ਪ੍ਰਗਟ ਕੀਤੀ ਅਤੇ ਮੈਨੂੰ ਮੇਰੇ ਇਸ ਸ਼ੌਕ ਬਾਰੇ ਕਾਫੀ ਸਰਾਹਿਆ ਉਹ ਮੇਰੀ ਇਹ ਕਲੈਕਸ਼ਨ ਦੇਖ ਕੇ ਕਾਫੀ ਪ੍ਰਭਾਵਿਤ ਵੀ ਹੋਏ ਜਿਸ ਦਾ ਕਿ ਉੱਥੇ ਮੌਜੂਦ ਕਾਫੀ ਲੋਕਾਂ 'ਤੇ ਬਹੁਤ ਹੀ ਜ਼ਿਆਦਾ ਪੋਜ਼ਟਿਵ ਪ੍ਰਭਾਵ ਪਿਆ